ਵੈਸੇ ਤਾਂ ਜਿਹੜਾ ਕਿ ਮੈਂ ਪਹਿਲਾਂ ਤੋਂ ਜਿਹੜੀ ਡਰਾਇੰਗ ਕਰਦਾ ਆਇਆ ਹਾਂ ਪਰ ਡਰਾਇੰਗ ਦੇ ਨਾਲ ਨਾਲ ਮੈਨੂੰ ਮੇਰਾ ਮਨ ਸੀਗਾ ਕਿ ਮੈਂ ਚਿੱਤਰਕਾਰੀ ਵੀ ਜਿਹੜੀ ਪੇਂਟਿੰਗ ਵੀ ਕਰਨੀ ਸ਼ੁਰੂ ਕਰਾਂ ਉਹ ਪੇਂਟਿੰਗ ਨੂੰ ਸ਼ੁਰੂ ਕਰਨ ਲਈ ਮੈਂ ਯੂਟੀਊਬ ਦੀ ਮਦਦ ਲਈ ਯੂਟੀਊਬ 'ਤੇ ਮੈਂ ਕਾਫੀ ਜ਼ਿਆਦਾ ਚੈਨਲ ਦੇਖੇ ਕਿ ਮੈਨੂੰ ਇੱਕ ਵਧੀਆ ਜਿਹੜਾ ਕਿ ਪਲੇਟਫਾਰਮ ਮਿਲ ਸਕੇ ਤਾਂ ਕਿ ਮੈਂ ਪੇਂਟਿੰਗ ਸਿੱਖ ਸਕਾਂ ਬਹੁਤ ਸਾਰੇ ਪਲੇਟੀ ਪਲੇਟਫਾਰਮ 'ਤੇ ਦੇਖਣ ਤੋਂ ਬਾਅਦ ਮੈਨੂੰ ਇੱਕ ਦੋ ਪਲੇਟਫਾਰਮ ਮਿਲੇ ਜਿਨ੍ਹਾਂ ਦੇ ਉੱਤੇ ਮੈਂ ਵਿਜਿਟ ਕੀਤਾ ਅਤੇ ਉਹਨਾਂ ਦੀ ਵੀਡੀਓ ਦੇਖੀਆਂ ਤਾਂ ਮੈਨੂੰ ਕਾਫੀ ਨੌਲੇਜ ਮਿਲੀ ਕਿ ਅਸੀਂ ਬਰੱਸ਼ ਨੂੰ ਕਿਸ ਤਰ੍ਹਾਂ ਹੋਲਡ ਕਰਦੇ ਹਾਂ ਪੇਂਟਿੰਗ ਦੀ ਸਟਾਰਟਿੰਗ ਤੋਂ ਲੈ ਕੇ ਐਂਡਿੰਗ ਤੱਕ ਪੂਰਾ ਲੁੱਕ ਜਿਹੜੀ ਕਿ ਮੈਨੂੰ ਇਹਨਾਂ ਵੀਡੀਓ ਦੇ ਵਿੱਚ ਸਿਖਾਈ ਗਈ ਇਹਨਾਂ ਵੀਡੀਓ ਵਿੱਚ ਮੈਨੂੰ ਇਹ ਵੀ ਦੱਸਿਆ ਗਿਆ ਪੇਂਟਿੰਗ ਸਟਾਰਟ ਕਿਵੇਂ ਕਰਨੀ ਹੈ ਅਤੇ ਪੇਂਟਿੰਗ ਕਰਦੇ ਸਮੇਂ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਤਾਂ ਕਿ ਤੁਹਾਡੀ ਜਿਹੜੀ ਪੇਂਟਿੰਗ ਹੈ ਉਹ ਖਰਾਬ ਨਾ ਹੋਵੇ ਬਰੱਸ਼ ਕਿਵੇਂ ਫੜਨਾ ਹੈ ਕਿਹੜੇ ਕਿਹੜੇ ਕਲਰ ਕਿਹੜੇ ਕਲਰ ਨੂੰ ਮਿਲਾਉਣਾ ਕਿਹੜਾ ਕਲਰ ਮਿਲਾ ਕੇ ਨਵਾਂ ਰੰਗ ਬਣਦਾ ਹੈ ਕਿਹੜਾ ਰੰਗ ਆ ਜਿਹੜਾ ਕਿ ਘੱਟ ਚਲਾਉਣਾ ਮਤਲਬ ਘੱਟ ਫੇਰਨਾ ਕਿਹੜਾ ਰੰਗ ਜ਼ਿਆਦਾ ਫੇਰਨਾ ਆ ਕਿੱਦਾਂ ਜਿਹੜੀ ਪੇਂਟਿੰਗ ਦੀ ਆਊਟਲਾਈਨਿੰਗ ਕਰਨੀ ਆ ਪੇਂਟਿੰਗ ਵਿੱਚ ਡਿਜ਼ਾਇਨਿੰਗ ਕਿੱਦਾਂ ਦੀ ਕਰਨੀ ਸਾਰਾ ਮੈਨੂੰ ਇਹਨਾਂ ਵੀਡੀਓਸ ਦੇ ਵਿੱਚ ਦੱਸਿਆ ਗਿਆ ਇਹਨਾਂ ਵੀਡੀਓਜ਼ ਦੇ ਵਿੱਚ ਮੈਨੂੰ ਹੋਰ ਵੀ ਬਹੁਤ ਸਾਰੀ ਜਾਣਕਾਰੀ ਦਿੱਤੀ ਕਿ ਜਿੱਦਾਂ ਅਸੀਂ ਪੇਂਟਿੰਗ ਕਈ ਵਾਰੀ ਬਣਾਉਂਦੇ ਹਾਂ ਪੇਂਟਿੰਗ ਕਰਦੇ ਸਾਡੇ ਤੋਂ ਕੋਈ ਰੰਗ ਗਲਤ ਭਰਿਆ ਜਾਂਦਾ ਆ ਜਾਂ ਕੁਛ ਖਰਾਬੀ ਹੋ ਜਾਂਦੀ ਹੈ ਪੇਂਟਿੰਗ ਦੇ ਵਿੱਚ ਤਾਂ ਉਹ ਇਸ ਖਰਾਬੀ ਨੂੰ ਕਿਸ ਤਰ੍ਹਾਂ ਠੀਕ ਕਰਨਾ ਹੈ ਉਸ ਖਰਾਬੀ ਨੂੰ ਕਿਸ ਤਰ੍ਹਾਂ ਇੰਮਪਰੂਵ ਕਰਨਾ ਹੈ ਸਾਰਾ ਕੁਛ ਇਹਨਾਂ ਵੀਡੀਓ ਦੇ ਵਿੱਚ ਦੱਸਿਆ ਗਿਆ ਇਹਨਾਂ ਸਿੱਖਣ ਲਈ ਇਸ ਕਰਕੇ ਮੇਰਾ ਯੂਟੀਊਬ ਨੇ ਬਹੁਤ ਜ਼ਿਆਦਾ ਸਾਥ ਦਿੱਤਾ ਕਈ ਚੈਨਲ ਐਦਾਂ ਦੇ ਹਨ ਜਿਨ੍ਹਾਂ ਦੇ ਵਿੱਚ ਉੱਪਰ ਲਿਖਿਆ ਕੁਛ ਸੀ ਪਰ ਵਿੱਚੋਂ ਕੁਛ ਨਹੀਂ ਨਿਕਲਿਆ ਫੇਕ ਵਿਊਜ ਪਾਉਣ ਲਈ ਉਹਨਾਂ ਨੇ ਵੀਡੀਓ ਪਾਈਆਂ ਹੋਈਆਂ ਸੀ ਪਰ ਜਿਹੜੇ ਚੈਨਲ ਮੈਂ ਦੇਖੇ ਉਹਨਾਂ ਵਿੱਚੋਂ ਕਈ ਐਦਾਂ ਦੇ ਚੈਨਲ ਸੀ ਜਿਨ੍ਹਾਂ ਨੇ ਮੇਰੀ ਬਹੁਤ ਹੈਲਪ ਕੀਤੀ ਅਤੇ ਮੇਰੀ ਪੇਂਟਿੰਗ ਹੁਣ ਹੌਲੀ ਹੌਲੀ ਕਰਦੇ ਕਰਦੇ ਜੇ ਮੈਂ ਡੇਕੀ ਡੇਲੀ ਪ੍ਰੈਕਟਿਸ ਕਰਦਾ ਰਿਹਾ ਤਾਂ ਇੱਕ ਦਿਨ ਮੈਂ ਜ਼ਰੂਰ ਇੱਕ ਐਕਸਪਰਟ ਬਣ ਜਾਵਾਂਗਾ ਬਹੁਤ ਸਾਰੇ ਔਨਲਾਈਨ ਸਰੋਤ ਹਨ ਜਿੱਦਾਂ ਜਿਹਦੇ ਤੋਂ ਮੈਂ ਯੂਟੀਊਬ ਤੋਂ ਸਿੱਖਦੇ ਨਾਲ ਨਾਲ ਨਹੀਂ ਮੈਂ ਆਪਣਾ ਮੇਰਾ ਇੱਕ ਦੋਸਤ ਸੀ ਉਸ ਤੋਂ ਵੀ ਹੈਲਪ ਲਈ ਕਿਉਂਕਿ ਉਸ ਨੂੰ ਵੀ ਪੇਂਟਿੰਗ ਚੰਗੀ ਤਰ੍ਹਾਂ ਆਉਂਦੀ ਸੀ ਉਹ ਵੀ ਪੇਂਟਿੰਗ ਦੇ ਵਿੱਚ ਬਹੁਤ ਜ਼ਿਆਦਾ ਐਕਸਪਰਟਸ ਨੇ ਇਹਦੀ ਪੇਂਟਿੰਗ ਕਰਦੇ ਕਰਦੇ ਜੇ ਮੈਂ ਕਰਦਾ ਰਿਹਾ ਤਾਂ ਮੇਰੀ ਪੇਂਟਿੰਗ ਇੱਕ ਦਿਨ ਜ਼ਰੂਰ ਵਧੀਆ ਹੋ ਜਾਵੇਗੀ ਮੇਰਾ ਦੋਸਤ ਵੀ ਮੇਰੀ ਇਹਦੀ ਹੈਲਪ ਕਰਦਾ ਰਹੇਗਾ ਅਤੇ ਹੋਰ ਵੀ ਚੈਨਲ ਹੈ ਮੈਂ ਤੁਹਾਨੂੰ ਰੈਕਾਮੈਂਡ ਨਹੀਂ ਕਰ ਸਕਦਾ ਕਿਉਂਕਿ ਉਹ ਚੈਨਲ ਬਹੁਤ ਹੀ ਵਧੀਆ ਨੇ ਤੋਂ ਮੈਂ ਇਹੀ ਕਹਿੰਦਾ ਕਿ ਮੇਰੀ ਯੂਟਿਊਬ ਨੇ ਇਸ ਮੇਰੀ ਚਿੱਤਰਕਾਰੀ ਔਰ ਮੇਰੀ ਪੇਂਟਿੰਗ ਕਰਨ ਦੇ ਵਿੱਚ ਬਹੁਤ ਜ਼ਿਆਦਾ ਹੈਲਪ ਕੀਤੀ ਹੈ